ਹੈਲੋ ਜੀ ਆਨਲਾਈਨ ਮੋਬਾਈਲ ਬਾਰੇ ਪੁੱਛਣਾ ਸੀ ਆਨਲਾਈਨ ਮੋਬਾਈਲ ਇੱਕ ਜਿਵੇਂ ਸੈਮਸੰਗ ਦੇ ਕਈ ਮੋਡਲਸ ਆਉਂਦੇ ਹੈ ਲੇਟੈਸਟ ਆਏ ਹੈ ਅਤੇ ਉਹਨਾਂ ਦੇ ਵਿੱਚੋਂ ਕੋਈ ਹੈ ਜੀ ਤੁਹਾਡੇ ਕੋਲ ਅਤੇ ਥੋੜ੍ਹਾ ਜਿਹਾ ਦੱਸੋਗੇ ਜੇ ਕਿਸ ਤਰ੍ਹਾਂ ਦੇ ਮਾਡਲ ਹੈ ਉਹਨਾਂ ਦੇ ਵਿੱਚ ਰੰਗ ਰੁੰਗ ਵੀ ਆਉਂਦੇ ਆ ਥੋੜ੍ਹੇ ਅਲੱਗ ਅਲੱਗ ਮੈਂ ਅ ਇੱਕ ਫੋਨ ਲੈਣਾ ਅਤੇ ਮੈਨੂੰ ਲ ਉਹ ਮਤਲਬ ਚਾਹੀਦਾ ਹਲਕੇ ਰੰਗ ਦੇ ਵਿੱਚ ਫੋਨ ਚਾਹੀਦਾ ਅੱਛਾ ਜੀ ਤੁਸੀਂ ਇਹਦਾ ਥੋੜ੍ਹਾ ਜਿਹਾ ਮੈਨੂੰ ਉਹ ਰੇਟ ਵਗੈਰਾ ਦੱਸ ਦਿਓ ਬਈ ਇਹਨਾਂ ਦੀ ਰੇਂਜ ਕਿਵੇਂ ਕਿਵੇਂ ਹੈ ਅੱਛਾ ਜੀ ਮੈਂ ਹੁਣ ਇੱਕ ਨਾ ਇਹਦਾ ਲੇਟੈਸਟ ਮਾਡਲ ਵੇਖਿਆ ਸੀ ਅਤੇ ਉਹ ਮੈਨੂੰ ਲੱਗਦਾ ਹੈਗਾ ਸੀ ਜੀ ਚੌਵੀ ਹਜ਼ਾਰ ਦਾ ਹੈ ਸੀ ਉਹ ਫੋਨ ਅਤੇ ਉਹ ਚਾਹੀਦਾ ਸੀ ਜੀ ਮੈਨੂੰ ਅਤੇ ਗਰੀਨ ਕਲਰ ਦੇ ਵਿੱਚ ਸੀ ਉਹ ਅਤੇ ਉਹ ਫੋਨ ਜੇ ਲਈਏ ਤਾਂ ਉਹ ਮਤਲਬ ਈ ਐਮ ਆਈ 'ਤੇ ਹੋ ਜੇਗਾ ਜੀ ਆਪਣੇ ਅਤੇ ਅੱਛਾ ਫਿਰ ਤੁਸੀਂ ਇਹਦਾ ਥੋੜ੍ਹਾ ਪ੍ਰੋਸੀਜਰ ਵਗੈਰਾ ਦੱਸ ਦਿਓ ਕਿ ਮਤਲਬ ਕਿਵੇਂ ਇਹਦੀ ਮੈਮਰੀ ਵਗੈਰਾ ਕਿੰਨੀ ਕੈਮਰਾ ਕੁਆਲਿਟੀ ਵਧੀਆ ਹੈ ਇਹਦੀ ਥੋੜ੍ਹਾ ਐਡਵਾਈਸ ਕਰ ਦਿਓ ਅੱਛਾ ਅਤੇ ਇਹਦੀ ਅ ਸਪੇਸ ਮੈਮਰੀ ਵਗੈਰਾ ਦਾ ਕੋਈ ਬਾਅਦ 'ਚ ਪ੍ਰੋਬਲਮ ਤਾਂ ਨਹੀਂ ਹੋਵੇਗੀ ਜੀ ਇਹਦੀ ਵਧੀਆ ਰਹੇਗੀ ਇਹ ਅੱਛਾ ਜੀ ਵਾਰੰਟੀ ਵੀ ਮਿਲੇਗੀ ਨਾਲ ਅੱਛਾ ਠੀਕ ਹੈ ਮਤਲਬ ਵਿੱਚ ਵਿੱਚ ਹੈ ਨਾ ਜਾਵੇ ਖ਼ਰਾਬ ਹੋ ਜੇ ਅਤੇ ਬਾਅਦ 'ਚ ਫਿਰ ਸਹੀ ਵੀ ਕਰਵਾ ਸਕਦੀ ਹਾਂ ਮੈਂ ਅੱਛਾ ਜੀ ਉਹ ਫਿਰ ਉਹਦਾ ਗਰੰਟੀ ਵਰੰਟੀ ਕਾਰਡ ਜਿਹੜਾ ਉਹ ਤੁਸੀਂ ਨਾਲ ਦਉਗੇ ਨਾ ਅੱਛਾ ਜੀ ਠੀਕ ਹੈ ਅਤੇ ਫਿਰ ਤੁਸੀਂ ਇਹਦੇ ਮਤਲਬ ਇਹ ਹੀ ਆਲਮੋਸਟ ਤੁਸੀਂ ਕਰ ਦਿਓ ਪੱਕਾ ਅਤੇ ਬਾਕੀ ਅਸੀਂ ਹੋਰ ਵਿਖਾ ਲਾਂਗੇ ਜਿਹੜੇ ਹੋਰ ਵੀ ਕੋਈ ਚਾਹੀਦੇ ਹੋਣਗੇ ਤਾਂ ਤੁਸੀਂ ਇਹਦਾ ਬਿੱਲ ਵਗੈਰਾ ਤੇ ਬਣਾ ਦਿਓ ਅਤੇ ਸਿਸਟਮ ਕਰ ਦਿਓ ਸਾਰਾ ਸਹੀ ਇਹਦਾ ਇਹ ਫੋਨ ਤੁਸੀਂ ਫਾਈਨਲ ਹਾਂਜੀ ਔਨਲਾਈਨ ਹੀ ਕਰ ਦਿਓ ਤੁਸੀਂ ਔਨਲਾਈਨ ਹੀ ਆਰਡਰ ਕਰਨਾ ਸੀ ਠੀਕ ਓਕੇ ਜੀ ਪੇਮੈਂਟ ਜੀ ਤੁਸੀਂ ਜਿਵੇਂ ਕਹੋਗੇ ਮੈਂ ਤੁਹਾਨੂੰ ਹੁਣ ਜਿਵੇਂ ਦੱਸਿਆ ਕਿ ਈ ਐਮ ਆਈ ਕੁਝ ਈ ਐਮ ਆਈ 'ਤੇ ਕਰ ਦਾਂਗੇ ਅਤੇ ਕੁਝ ਤੁਹਾਨੂੰ ਹੁਣ ਸੈਂਡ ਕਰ ਦਾਂਗੇ ਤੁਸੀਂ ਆਪਣਾ ਨੰਬਰ ਵਗੈਰਾ ਭੇਜ ਦਿਓ ਅਤੇ ਤੁਸੀਂ ਮੈਨੂੰ ਹੁਣ ਆਪਣਾ ਭੇਜ ਦਿਓ ਨੰਬਰ ਵਗੈਰਾ ਤੁਹਾਨੂੰ ਅੱਧੀ ਪੇਮੈਂਟ ਹੁਣ ਕਰ ਦਾਂਗੇ ਅਤੇ ਅੱਧੀ ਦੀ ਈ ਐਮ ਆਈ ਵਗੈਰਾ ਬਣਾ ਦਿਓ ਤੁਸੀਂ ਅਤੇ ਫਿਰ ਉਹ ਤੁਹਾਨੂੰ ਅ ਪਰ ਮੰਥ ਹਰ ਮਹੀਨੇ ਅਸ ਭੇਜਦੇ ਰਹਾਂਗੇ ਹਾਂਜੀ ਠੀਕ ਹੈ ਜੀ ਠੀਕ ਓਕੇ